ਇੱਦਾਂ ਤਾਂ ਬਹੁਤ ਸਾਰੇ ਸਕੂਲ ਕੋਲਜ ਹਨ ਜਿੱਥੇ ਡਿਗਰੀ ਮਿਲਦੀ ਹੈ ਪਰ ਮੇਰਾ ਦਿਲ ਦਿੱਲੀ ਕੋਲਜ ਔਫ ਫੋਟੋਗ੍ਰਾਫੀ ਮੇਰਾ ਮਨਪਸੰਦ ਹੈ ਕਿਉਂਕਿ ਉੱਥੇ ਉਹਨਾਂ ਦਾ ਪੜ੍ਹਾਉਣ ਦਾ ਢੰਗ ਬਹੁਤ ਵਧੀਆ ਹੈ ਉੱਥੇ ਰਹਿਣ ਸਹਿਣ ਦੀ ਉੱਥੇ ਰਹਿਣ ਸਹਿਣ ਦਾ ਵੀ ਪੂਰਾ ਪ੍ਰਬੰਧ ਹੈ ਮੈਂ ਵੈਸੇ ਤਾਂ ਉੱਥੇ ਬਹੁਤ ਸਾਰੇ ਕੋਲਜ ਹਨ ਪਰ ਮੈਨੂੰ ਦਿੱਲੀ ਕੋਲਜ ਔਫ ਫੋਟੋਗ੍ਰਾਫੀ ਹੀ ਵਧੀਆ ਲੱਗਦੀ ਹੈ ਮੈਨੂੰ ਉਹਨਾਂ ਦੀ ਮੈਨੂੰ ਉਹਨਾਂ ਦੀ ਚੀਜ਼ਾਂ ਅਤੇ ਰਹਿਣ ਸਹਿਣ ਦਾ ਢੰਗ ਬਹੁਤ ਵਧੀਆ ਲੱਗਦਾ ਹੈ